ਅਸੀਂ ਵੀ ਪਹਿਲਾਂ ਵੀ ਉਹਦੇ ਬਾਰੇ ਗੱਲ ਕੀਤੀ ਹੈ ਦੁਆਰਾ ਫੇਰ ਉਹੀ ਹੈ ਖੇਡਾਂ ਕੀ ਹੈ ਜਦੋਂ ਤੱਕ ਅਸੀਂ ਨਹੀਂ ਸੋਚਦੇ ਕਿ ਸਾਡਾ ਪਰਿਵਾਰ ਸਾਡੀ ਸਿਹਤ ਉਹਦੇ ਨਾਲ ਹੀ ਇਹ ਖੇਡਾਂ ਹੈ ਸਵੇਰੇ ਉੱਠਣਾ ਅਸੀਂ ਸਮੇਂ ਸਿਰ ਉੱਠਦੇ ਨਹੀਂ ਹੈ ਖੇਡਣ ਨਾਲ ਹੀ ਸਾਡਾ ਸਾਰਾ ਕੁਝ ਚੱਲਦਾ ਹੈ ਜਿਹਨੂੰ ਅਸੀਂ ਕਹਿੰਦੇ ਹੈ ਅਗਰ ਅਸੀਂ ਸਾਡਾ